ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਗੈਸ 'ਤੇ ਖਾਣਾ ਬਣਾਉਣੇ ਹਾਂ ਜਾਂ ਚਾਹ ਬਣਾਉਣੇ ਹਾਂ ਤਾਂ ਸਾਨੂੰ ਗੈਸ ਸਹੀ ਤਰ੍ਹਾਂ ਬੰਦ ਕਰਨੀ ਚਾਹੀਦੀ ਹੈ ਅਗਰ ਗੈਸ ਸਹੀ ਤਰ੍ਹਾਂ ਬੰਦ ਨਹੀਂ ਹੋਈ ਤਾਂ ਦੁਬਾਰਾ ਅਗਰ ਅਸੀਂ ਮਾਚਿਸ ਜਾਂ ਲਾਇਟਰ ਔਨ ਕਰਾਂਗੇ ਤਾਂ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਸਾਨੂੰ ਗੈਸ ਕਦੇ ਵੀ ਮਾਚਿਸ ਔਨ ਸਿਲੰਡਰ ਲਾਗੇ ਮਾਚਿਸ ਔਨ ਕਰਕੇ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਉਹਦੇ ਲਾਗੇ ਕੋਈ ਵੀ ਔਇਲ ਵਗੈਰਾ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਇੱਕ ਸਿਲੰਡਰ ਰੱਖਦੇ ਹਾਂ ਤਾਂ ਉਹਦੇ ਨਾਲ ਹੀ ਦੂਸਰਾ ਸਿਲੰਡਰ ਨਹੀਂ ਰੱਖਣਾ ਚਾਹੀਦਾ ਅੱਗ ਸਾਨੂੰ ਦੋਨਾਂ ਵਿੱਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਸਾਨੂੰ ਖੁੱਲ੍ਹੀ ਬਾਹਵਾਂ ਵਾਲੇ ਕੱਪੜੇ ਪਾ ਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਜਦੋਂ ਖੁੱਲ੍ਹੀਆਂ ਬਾਹਵਾਂ ਵਾਲੇ ਕੱਪੜੇ ਪਾ ਕੇ ਨਹੀਂ ਜਾਣਾ ਚਾਹੀਦਾ ਸਾਨੂੰ ਗੈਸ ਨੂੰ ਬੰਦ ਏਰੀਏ ਵਾਲੀ ਜਗ੍ਹਾ 'ਤੇ ਨਹੀਂ ਰੱਖਣਾ ਚਾਹੀਦਾ ਉਸਨੂੰ ਸਰਫੇਸ ਦੇ ਉੱਪਰ ਜਾਨੀ ਕਿ ਜ਼ਮੀਨ ਦੇ ਉੱਪਰ ਹੀ ਰੱਖਣਾ ਚਾਹੀਦਾ ਹੈ ਸਾਨੂੰ ਸਿਲੰਡਰ ਦੇ ਜਦੋਂ ਵੀ ਅਸੀਂ ਕਿਸੇ ਸਿਲੰਡਰ ਨੂੰ ਰੱਖਦੇ ਹਾਂ ਤਾਂ ਉਹਦੇ ਉੱਪਰ ਗੈਪ ਬਣਾ ਕੇ ਹੀ ਸਾਨੂੰ ਜਿਹੜਾ ਗੈਸ ਰੱਖਣੀ ਚਾਹੀਦੀ ਹੈ ਅਤੇ ਛੋਟੇ ਬੱਚੇ ਨੂੰ ਗੈਸ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਛੋਟੇ ਬੱਚੇ ਰੈਗੂਲੇਟਰ ਔਫ ਜਾਂ ਔਨ ਕਰਨ ਦੇ ਚੱਕਰ ਵਿੱਚ ਉਹਨਾਂ ਕੋਲੋਂ ਪਾਈਪ ਖਰਾਬ ਹੋਣ ਦੇ ਚਾਂਸਿਸ ਬਣੇ ਰਹਿੰਦੇ ਹਨ ਜਿਸ ਕਰਕੇ ਗੈਸ ਲੀਕ ਹੋਣ ਦਾ ਖ਼ਤਰਾ ਰਹਿੰਦਾ ਹੈ ਇਸ ਕਰਕੇ ਸਾਨੂੰ ਕਾਫ਼ੀ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਛੋਟੇ ਬੱਚਿਆਂ ਨੂੰ ਗੈਸ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ